ਕੁਝ ਸਾਲ ਪਹਿਲੇ ਅਤੇ ਅੱਜ ਦੇ ਫੋਨਾਂ ਦੇ ਵਿੱਚ ਬਹੁਤ ਅੰਤਰ ਹੈ ਜੀ ਪਹਿਲੇ ਦੇ ਫੋਨ ਸਿਰਫ ਅਤੇ ਸਿਰਫ ਨੋਕੀਆ ਦੇ ਫੋਨ ਹੁੰਦੇ ਸੀਗੇ ਜਾਂ ਬਟਨਾਂ ਵਾਲੇ ਫੋਨ ਦੇਖੇ ਜਾਂਦੇ ਸੀਗੇ ਮਟਰੋਲਾ ਦੇ ਸੋਨੀ ਅਰਿਕਸਨ ਦੇ ਫੋਨਾਂ ਦੀ ਬਣਤਰ ਜਿਹੜੀ ਸੀ ਉਹ ਮਜ਼ਬੂਤੀ ਬਹੁਤ ਜ਼ਿਆਦਾ ਸੀਗੀ ਜੇ ਡਿੱਗ ਵੀ ਜਾਂਦੇ ਸੀ ਬਟ ਉਹ ਟੁੱਟਦੇ ਨਹੀਂ ਸੀਗੇ ਚਲਦੇ ਰਹਿੰਦੇ ਸੀ ਬੈਟਰੀ ਬਹੁਤ ਲੋਂਗ ਲਾਈਫ ਸੀਗੀ ਉਹਨਾਂ ਦੀ ਚਲਦੀ ਰਹਿੰਦੀ ਸੀਗੀ ਬਟਨ ਦਬਾਉ ਅਤੇ ਕੋਲ ਕਰੋ ਨੈਟਵਰਕ ਦੀ ਪ੍ਰੋਬਲਮ ਹੁੰਦੀ ਸੀ ਕਿਉਂਕਿ ਉਦੋਂ ਐਨਾ ਜ਼ਿਆਦਾ ਵਿਕਸਿਤ ਨਹੀਂ ਸੀਗਾ ਆਪਣਾ ਆਪਣਾ ਨੈਟਵਰਕ ਇਸ਼ੂ ਜਿਹੜਾ ਸੀਗਾ ਅੱਜ ਦੀ ਡੇਟ 'ਚ ਬਹੁਤ ਜ਼ਿਆਦਾ ਟਾਵਰ ਹੋ ਗਏ ਨੇ ਅੱਜ ਦੇ ਜਿਹੜੇ ਫੋਨ ਨੇ ਉਹ ਸਮਾਰਟਫੋਨ ਆ ਗਏ ਨੇ ਪੁਰਾਣੇ ਫੋਨਾਂ ਦੇ ਵਿੱਚ ਕੈਮਰਾ ਨਹੀਂ ਸੀ ਅੱਜ ਦੇ ਫੋਨਾਂ ਵਿੱਚ ਕੈੈਮਰਾ ਹੈ ਪੁਰਾਣੇ ਫੋਨਾਂ ਦੇ ਵਿੱਚ ਕੋਈ ਵੀਡੀਓ ਕੋਲ ਨਹੀਂ ਸੀ ਹੁੰਦੀ ਜੇ ਕੈਮਰਾ ਹੀ ਨਹੀਂ ਹੋਏਗਾ ਤਾਂ ਵੀਡੀਓ ਕਿੱਦਾਂ ਆਏਗੀ ਬਟ ਪੁਰਾਣੇ ਫੋਨਾਂ ਦੇ ਵਿੱਚ ਇਹ ਸੀਗਾ ਕਿ ਵੀ ਤੁਸੀਂ ਸਿਰਫ ਫੋਨ ਕਰ ਸਕਦੇ ਸੀ ਅਤੇ ਸੁਣ ਸਕਦੇ ਸੀ ਬਟ ਅੱਜ ਦੇ ਫੋਨਾਂ ਦੇ ਵਿੱਚ ਤੁਸੀਂ ਜੀ ਪੀ ਐੱਸ ਯੂਟਿਊਬ ਫੇਸਬੁੱਕ ਤੁਸੀਂ ਘਰ ਬੈਠੇ ਕੋਈ ਵੀ ਔਨਲਾਈਨ ਚੀਜ਼ ਮੰਗਵਾ ਸਕਦੇ ਹੋ ਪੁਰਾਣੇ ਫੋਨਾਂ ਦੇ ਵਿੱਚ ਇਹ ਚੀਜ਼ ਬਿਲਕੁਲ ਵੀ ਨਹੀਂ ਸੀ ਮੈਂ ਜਿਹੜਾ ਇਹ ਸਿਮ ਯੂਜ਼ ਕਰਦਾ ਹਾਂ ਉਹ ਹੈ ਵੋਡਾਫੋਨ ਆਈਡੀਆ ਇਹਦਾ ਜਿਹੜਾ ਮੰਥਲੀ ਰੀਚਾਰਜ ਆਉਂਦਾ ਉਹ ਥ੍ਰੀ ਮੰਥਸ ਦਾ ਆਉਂਦਾ ਤਿੰਨ ਮਹੀਨਿਆਂ ਲਈ ਆਉਂਦਾ ਸੱਤ ਸੌ ਰੇ ਉੱਨੀ ਰੁਪਏ ਦਾ ਉਹ ਚਲਾਈ ਦਾ ਅਤੇ ਠੀਕ ਹੈ ਚੱਲ ਰਿਹਾ ਬਾਕੀ ਇਹ ਕਿ ਵੀ ਥੋੜ੍ਹਾ ਜਿਹਾ ਕਿਤੇ ਉਰੇ ਪਰੇ ਹੋ ਜਾਓ ਕਿਤੇ ਸੁੰਨਸਾਨ ਜਗ੍ਹਾ 'ਤੇ ਚਲੇ ਜਾਓ ਅਤੇ ਉੱਥੇ ਨਹੀਂ ਚਲਦਾ ਬਾਕੀ ਸਿਟੀ ਵਿੱਚ ਬਹੁਤ ਵਧੀਆ ਹਾਈਵੇਜ਼ 'ਤੇ ਬਹੁਤ ਵਧੀਆ ਨੈਵੀਗੇਸ਼ਨਸ ਹੈ ਵਧੀਆ ਜੀ